ਮੈਂ ਅੰਗਰੇਜ਼ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ

ਅਸੀਂ ਕੁਝ ਦਿਨਾਂ ਤੋਂ ਦੇਵੀ ਦੇਵਤਿਆਂ ਦੇ ਦਰਸ਼ਨ ਕਰਨ ਲਈ ਪਹਾੜਾਂ ਦੇ ਵਿੱਚ ਗਏ ਹੋਏ ਸੀ ਤਾਂ ਕਿ ਅਸੀਂ ਬਹੁਤ ਦੇਵੀ ਦੇਵਤਿਆਂ ਦੇ ਦਰਸ਼ਨ ਕੀਤੇ ਅਸੀਂ ਪਹਾੜਾਂ 'ਤੇ ਘੁੰਮੇ ਪਹਾੜਾਂ 'ਤੇ ਬਹੁਤ ਉੱਚੀ ਉੱਚੀ ਚੋਟੀਆਂ 'ਤੇ ਗਏ ਸਾਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਿਆ ਕਿਉਂਕਿ ਉਸ ਤੋਂ ਬਾਅਦ ਅਸੀਂ ਘਰ ਆਉਣ ਲਈ ਸੋਚਿਆ ਕੁਝ ਦਿਨਾਂ ਬਾਅਦ ਘਰ ਆਉਣ ਲਈ ਸੋਚਿਆ ਅਸੀਂ ਰਸਤੇ ਦੇ ਵਿੱਚ ਪਹੁੰਚ ਗਏ ਸੀ ਰਸਤੇ ਵਿੱਚ ਪਹੁੰਚਣ ਲਈ ਸਾਨੂੰ ਕੁਛ ਕੁ ਸਮਾਂ ਲੱਗ ਗਿਆ ਸੀਗਾ ਤਾਂ ਕਿ ਅਸੀਂ ਕੁਛ ਦਿਨਾਂ ਬਾਅਦ ਘਰ ਦੇ ਵਿੱਚ ਪਹੁੰਚ ਗਏ ਸੀ ਘਰ ਵਿੱਚ ਪਹੁੰਚਣ ਲਈ ਪਹੁੰਚ ਕੇ ਅਸੀਂ ਜੋ ਕਿ ਅਸੀਂ ਰੈਸਟ ਕੀਤੀ ਰੈਸਟ ਕਰਕੇ ਅਸੀਂ ਆਪਣੇ ਘਰ ਵਿੱਚ ਖਾਣਾ ਬਣਾਉਣ ਲਈ ਸੋਚਿਆ ਖਾਣਾ ਬਣਾਉਣ ਲਈ ਜੋ ਕਿ ਸਾਡੇ ਘਰ ਦੇ ਵਿੱਚ ਗੈਸ ਸਲੰਡਰ ਖਤਮ ਸੀ ਤਾਂ ਕਿ ਸਾਨੂੰ ਇੱਕ ਗੈਸ ਸਲੰਡਰ ਦੀ ਲੋੜ ਸੀ ਮੈਂ ਗੈਸ ਏਜੰਸੀ ਵਿੱਚ ਅਪੀਲ ਕਰਦਾ ਹਾਂ ਕਿ ਮੈਨੂੰ ਜਲਦੀ ਤੋਂ ਜਲਦੀ ਇੱਕ ਗੈਸ ਸਲੰਡਰ ਦੀ ਬੁਕਿੰਗ ਕੀਤੀ ਜਾਵੇ ਤਾਂ ਕਿ ਜੋ ਮੈਂ ਆਪਣੇ ਘਰ ਦੇ ਵਿੱਚ ਖਾਣਾ ਬਣਾ ਸਕਾਂ ਹਾਂ ਮੈਂ ਅੰਗਰੇਜ਼ ਸਿੰਘ ਜੋ ਕਿ ਆਪਣਾ ਗੈਸ ਏਨਸੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਅੰਗਰੇਜ਼ ਸਿੰਘ ਧੰਨਵਾਦ